ਹਾਂਜੀ ਹੈਲੋ ਨਮਸਤੇ ਹਰੇਕ ਤਰ੍ਹਾਂ ਦੀ ਸਬਜ਼ੀਆਂ ਜੀ ਆਪਣੇ ਕੋਲ ਆਲੂ ਗੋਭੀ ਹਰੇਕ ਤਰ੍ਹਾਂ ਦੀ ਹੈ ਜੀ ਮਤਲਬ ਕਿ ਮਟਰ ਜੋ ਵੀ ਤੁਸੀਂ ਲੈਣਾ ਚਾਹੋ ਹਰੇਕ ਤਰ੍ਹਾਂ ਦੀ ਸਬਜ਼ੀ ਹੈ ਕਰੇਲੇ ਜਿਸ ਤਰ੍ਹਾਂ ਆਪਣੇ ਕੋਲ ਆਲੂ ਗੋਭੀ ਬਿਨਾ ਖਾਦ ਤੋਂ ਹੈ ਅਤੇ ਮਟਰ ਵਗੈਰਾ ਹੈ ਆਪਣੇ ਕੋਲ ਬਿਨਾ ਖਾਦ ਤੋਂ ਹੈ ਅਤੇ ਹਾਂਜੀ ਹਾਂਜੀ ਇਹਨਾਂ ਵਿੱਚ ਆਪਾਂ ਬਿਲਕੁਲ ਖਾਦ ਵਗੈਰਾ ਨਹੀਂ ਯੂਜ ਕਰੀਦੀ ਅਤੇ ਮੂਲੀਆਂ ਵਗੈਰਾ ਪਾਲਕ ਵਗੈਰਾ ਇਹ ਸਭ ਮਤਲਬ ਕਿ ਆਪਣੇ ਕੋਲ ਬਿਨਾ ਖਾਦ ਤੋਂ ਸਬਜ਼ੀਆਂ ਹੈ ਹਾਂਜੀ ਬਿਮਾਰ ਵਗੈਰਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਰੋਜ਼ ਰੋਜ਼ ਕਰਦਿਆਂ ਕਰਾਂਗੇ ਜੀ ਅਤੇ ਆਪਣੇ ਸਾਰੀਆਂ ਹੀ ਵਧੀਆ ਤਕਰੀਬਨ ਤਾਂ ਤੁਸੀਂ ਦੱਸੋ ਕਿਹੜੀ ਲੈਣੀ ਹੈ ਕਿੰਨੇ ਕਿੰਨੇ ਕਿੱਲੋ ਕਰਨੀਆਂ ਨੇ ਜਿਵੇਂ ਮੂਲੀਆਂ ਸਾਗ ਪਾਲਕ ਗਾਜਰਾਂ ਮਟਰ ਵਗੈਰਾ ਇਹ ਤਾਂ ਸੀਜ਼ਨ ਦੇ ਹਿਸਾਬ ਨਾਲ ਹੈ ਨਾ ਹਾਂਜੀ ਇਹ ਤਾਂ ਕਿਉਂਕਿ ਕਿੰਨਾ ਕਿੰਨਾ ਕਰਨਾ ਹੈ ਕਿੰਨੇ ਕਿੰਨੇ ਬਾਕੀ ਸਬਜ਼ੀਆਂ ਟਮਾਟਰ ਵਗੈਰਾ ਕਿੰਨੇ ਕਿੰਨੇ ਕਿੱਲੋ ਕਰਨੇ ਹੈ ਹਾਂਜੀ ਹਾਂਜੀ ਹਾਂਜੀ ਅਤੇ ਨਹੀਂ ਪੂਰੀ ਕਰਾਂਗੇ ਜੀ ਹਾਂਜੀ ਮਿਰਚਾਂ ਆਪਣੇ ਨਹੀਂ ਨਹੀਂ ਖਾਦਾਂ ਵਾਲੀਆਂ ਨਹੀਂ ਹੈਗੀਆਂ ਆਪਣੇ ਕੋਲੋਂ ਵਧੀਆ ਸਬਜ਼ੀਆਂ ਹੈ ਬਿਨਾ ਖਾਦ ਤੋਂ ਹੈ ਕੋਈ ਟੈਂਸ਼ਨ ਨਹੀਂ ਲੈਣੀ ਹਾਂਜੀ ਅਦਰਕ ਵਗੈਰਾ ਲੈਣੀ ਹੈ ਹਾਂਜੀ ਠੀਕ ਇਹ ਮੈਂ ਸਾਰੇ ਪੈਕ ਕਰਵਾ ਕੇ ਸ਼ਾਮ ਨੂੰ ਤੁਹਾਡੇ ਘਰ ਪਹੁੰਚਾ ਦੇਵਾਂਗੇ ਅਤੇ ਤੁਸੀਂ ਬੇਫਿਕਰੇ ਹੋ ਜਾਉ ਚਲੋ ਕੋਈ ਨਹੀਂ ਖਾਤਾ ਪਾ ਦਿੰਦੇ ਹਾਂਜੀ ਹਾਂਜੀ ਹਾਂਜੀ ਕੋਈ ਨਹੀਂ ਖਾਤਾ ਪਾ ਦਿੰਦੇ ਹਾਂ ਤੁਹਾਡਾ ਅਤੇ ਪੇਮੈਂਟ ਤੁਸੀਂ ਜਿਵੇਂ ਮਰਜ਼ੀ ਗੂਗਲ ਪੇ ਕਰੋ ਜਾਂ ਫੋਨਪੇ ਕਰੋ ਆਪਣੇ ਚਲਦਾ ਹੀ ਹੈ ਗੂਗਲ ਪੇ ਵੀ ਚਲਦਾ ਫੋਨਪੇ ਵੀ ਚਲਦਾ ਹਾਂਜੀ ਨਹੀਂ ਬੇਫਿਕਰੇ ਹੋ ਜਾਉ ਇਸ ਗੱਲੋਂ ਬੇਫਿਕਰੇ ਹੋ ਜਾਉ ਬੇਫਿਕਰੇ ਹੋ ਜਾਉ ਇਸ ਗੱਲੋਂ ਤੁਹਾਨੂੰ ਵਧੀਆ ਹੀ ਸਬਜ਼ੀਆਂ ਦੇਵਾਂਗੇ ਤੁਸੀਂ ਰੋਜ਼ ਦੇ ਸਾਡੇ ਕਸਟਮਰ ਆ ਹਾਂਜੀ ਹਾਂਜੀ ਨਾਲੇ ਤੁਸੀਂ ਰੋਜ਼ ਦੇ ਸਾਡੇ ਹੈਗੇ ਹੋ ਕਸਟਮਰ ਅਤੇ ਤੁਹਾਡੇ ਨਾਲ ਥੋੜ੍ਹੀ ਇਹੋ ਜਿਹੀ ਗੱਲ ਕਰਨੀ ਹੈ ਹਾਂਜੀ ਨਹੀਂ ਨਹੀਂ ਬੇਫਿਕਰੇ ਹੋ ਜਾਉ ਤੁਸੀਂ ਆਪਾਂ ਵਧੀਆ ਹੀ ਸਬਜ਼ੀਆਂ ਹਾਂ ਠੀਕ ਹੈ ਜੀ ਠੀਕ ਠੀਕ

ਹਾਂਜੀ ਹਾਂਜੀ ਜ਼ਰੂਰ ਪਹੁੰਚਾ ਦੇਵਾਂਗੇ ਹੋਰ ਹੁਕਮ ਕਰੋ